ਸਾਡੇ ਇਲਾਕੇ ਦੇ ਲੋਕ ਜ਼ਿਆਦਾਤਰ ਅੰਮ੍ਰਿਤਸਰ ਜਾਣਾ ਪਸੰਦ ਕਰਦੇ ਹਨ ਉੱਥੋਂ ਦਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹੈ ਅਤੇ ਸਾਰਾ ਦਿਨ ਕੀਰਤਨ ਚੱਲਦਾ ਰਹਿੰਦਾ ਹੈ ਅਤੇ ਰਾਤ ਨੂੰ ਗੁਰਦੁਆਰਾ ਵੇਖਣ ਯੋਗ ਹੁੰਦਾ ਹੈ ਅਤੇ ਉੱਥੇ ਲੰਗਰ ਚੱਲਦਾ ਹੈ ਅਤੇ ਬਜ਼ਾਰ ਦਾ ਦ੍ਰਿਸ਼ ਵੀ ਬਹੁਤ ਸੋਹਣਾ ਹੁੰਦਾ ਹੈ ਲੋਕ ਜਾ ਕੇ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਵੀ ਲੈ ਕੇ ਆਉਂਦੇ ਹਨ ਅਤੇ ਕੀਰਤਨ ਸੁਣਦੇ ਹਨ ਅਤੇ ਸਾਡੇ ਇਲਾਕੇ ਵਿੱਚ ਬਠਿੰਡੇ ਕਿਲ੍ਹੇ ਵਿੱਚ ਮੁਬਾਰਕਬਾਦ ਗੁਰਦੁਆਰਾ ਵੀ ਬਹੁਤ ਮਸ਼ਹੂਰ ਹੈ ਸਾਡੇ ਬਠਿੰਡੇ ਦੇ ਲੋਕ ਜ਼ਿਆਦਾਤਰ ਉੱਥੇ ਜਾਣਾ ਪਸੰਦ ਕਰਦੇ ਹਨ ਅਤੇ ਉੱਥੇ ਵੀ ਬਾਜ਼ਾਰ ਲੱਗਦਾ ਹੈ ਲੋਕ ਬਹੁਤ ਸਾਰੀਆਂ ਚੀਜ਼ਾਂ ਖਰੀਦਦੇ ਹਨ ਅਤੇ ਰਾਤ ਨੂੰ ਬਹੁਤ ਸੋਹਣਾ ਸਜਿਆ ਹੁੰਦਾ ਹੈ ਅਤੇ ਮੈਂ ਵੀ ਪਿਛਲੀ ਵਾਰ ਗੁਰਦੁਆਰਾ ਸਾਹਿਬ ਗਈ ਸੀ ਅਤੇ ਮੇਰੇ ਨਾਲ ਸਾਡਾ ਸਾਰਾ ਪਰਿਵਾਰ ਵੀ ਸੀ ਅਸੀਂ ਬਹੁਤ ਆਨੰਦ ਮਾਣਿਆ ਅਤੇ ਬਹੁਤ ਮਜ਼ਾ ਆਇਆ